ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਕੁਝ ਕਰ ਦਿਨਾਂ ਪਹਿਲੇ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਅੱਜ ਕੱਲ ਸਮਾਨ ਔਨਲਾਈਨ ਮੰਗਵਾਇਆ ਜਾ ਸਕਦਾ ਹੈ ਇਸ ਕਰਕੇ ਮੇਰੀ ਵੀ ਰੁਚੀ ਇਸ ਵਿੱਚ ਆਈ ਕਿ ਮੈਂ ਵੀ ਔਨਲਾਈਨ ਕੁਝ ਆਰਡਰ ਕਰਾਂ ਤਾਂ ਮੈਂ ਤੁਹਾਡੀ ਵੈਬਸਾਈਟ ਤੋਂ ਕੁਝ ਕਰ ਹਫਤੇ ਪਹਿਲੇ ਇੱਕ ਮੋਬਾਈਲ ਫੋਨ ਪਸੰਦ ਕਰਕੇ ਆਰਡਰ ਕਰ ਦਿੱਤਾ ਸੀ ਅਤੇ ਉਸ ਦੀ ਪੇਮੈਂਟ ਵੀ ਮੈਂ ਨਾਲੋਂ ਨਾਲ ਹੀ ਕਰ ਦਿੱਤੀ ਸੀ ਤਾਂ ਮੈਨੂੰ ਉਸ ਕੁਝ ਅੱਜ ਕਿਸੇ ਜ਼ਰੂਰੀ ਕੰਮ ਕਰਕੇ ਆਪਣੇ ਸ਼ਹਿਰੋਂ ਬਾਹਰ ਜਾਣਾ ਪੈ ਰਿਹਾ ਹੈ ਤਾਂ ਅੱਜ ਮੈਨੂੰ ਡਿਲੀਵਰੀ ਦੀ ਡੇਟ ਐਪ ਵਿੱਚ ਸ਼ੋ ਹੋ ਰਹੀ ਰਹੀ ਸੀ ਤਾਂ ਮੇਰਾ ਇਹ ਕਹਿਣਾ ਹੈ ਕਿ ਅੱਜ ਮੈਂ ਕਿਸੇ ਕੰਮ ਕਰਕੇ ਸ਼ਹਿਰ ਤੋਂ ਬਾਹਰ ਹਾਂ ਤਾਂ ਮੇਰੀ ਡਿਲੀਵਰੀ ਕੈਂਸਲ ਕਰ ਦਿੱਤੀ ਜਾਵੇ ਜਿਸ ਵਿੱਚ ਮੇਰੀ ਕੁੱਲ ਜਮ੍ਹਾਂ ਰਾਸ਼ੀ ਪੰਜ ਹਜ਼ਾਰ ਰੁਪਈਆ ਮੈਨੂੰ ਮੇਰੇ ਖਾਤੇ ਵਿੱਚ ਪਾ ਦਿੱਤਾ ਜਾਵੇ ਮੈਂ ਆਪ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਜਦੋਂ ਆਪਣੇ ਘਰ ਵਾਪਸ ਆ ਜਾਵਾਂਗਾ ਤਾਂ ਤੁਹਾਡੀ ਹੀ ਵੈੱਬਸਾਈਟ ਤੋਂ ਨਵਾਂ ਫੋਨ ਮੰਗਾਵਾਂਗਾ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਬਣਦੇ ਪੈਸੇ ਮੈਨੂੰ ਔਨਲਾਈਨ ਮੇਰੇ ਖਾਤੇ ਵਿੱਚ ਪਾ ਦਿੱਤੇ ਜਾਵੇ